ਪੰਜਾਬੀ ਭਾਸ਼ਾ ਨੇ ਬਹੁਤ ਹੀ ਸੰਘਰਸ਼ ਕੀਤਾ ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਸੀ ਕਿ ਰਾਜ ਦੀ ਉਥਲ ਪੁਥਲ ਹੁੰਦੀ ਰਹਿੰਦੀ ਸੀ ਜਿਸ ਕਾਰਨ ਪੰ ਇਸ ਭਾਸ਼ਾ ਦਾ ਚੰਗੀ ਤਰ੍ਹਾਂ ਵਿਕਾਸ ਨਾ ਹੋ ਸਕਿਆ ਜਿਹੜੇ ਹਮਲਾਵਰ ਸੀ ਉਹ ਪੰਜਾਬ ਦੇ ਪ੍ਰਵੇਸ਼ ਦੁਆਰ ਦੁਆਰ ਰਾਹੀਂ ਭੰ ਪੰਜਾਬ ਵਿੱਚ ਆਉਂਦੇ ਹੀ ਰਹਿੰਦੇ ਸਨ ਅਤੇ ਯੁੱਧ ਲਈ ਹਮੇਸ਼ਾ ਤਿਆਰ ਹੀ ਰਹਿੰਦੇ ਸਨ ਪੰਜਾਬੀ ਸਾਹਿਤ ਹੈ ਜੋ ਉਹ ਸ਼ਾਂਤੀ ਵਿੱਚ ਹੀ ਲਿਖਿਆ ਜਾ ਸਕਦਾ ਸੀ ਅਜੇ ਅਜ ਅਜਿਹਾ ਹੋਣ ਕਾਰਨ ਪੰਜਾਬੀ ਭਾਸ਼ਾ ਚੰਗੀ ਤਰ੍ਹਾਂ ਵਿਕਸਿਤ ਨਾ ਹੋ ਸਕੀ ਅਤੇ ਆਜ਼ਾਦੀ ਤੋਂ ਬਾਅਦ ਹੀ ਪੰਜਾਬੀ ਭਾਸ਼ਾ ਵਿਕਸਿਤ ਹੋਈ ਉੱਨੀ ਸੌ ਸੰਤਾਲੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ੀ ਰਾਜ ਹੋਣ ਕਾਰਨ ਬ੍ਰਿਟਿਸ਼ ਭਾਸ਼ਾ ਬੋਲਣ ਦਾ ਰਾ ਰਾ ਰਾਜ ਸੀ ਕਿਉਂਕਿ ਅੰਗਰੇਜ਼ ਆਪਣਾ ਰਾਜ ਕਰਦੇ ਸਨ ਪਰ ਆਜ਼ਾਦੀ ਤੋਂ ਬਾਅਦ ਗੁਰਮੁਖੀ ਲਿੱਪੀ ਹੋਂਦ ਵਿੱਚ ਆਈ ਜੋ ਅਤੇ ਪੰਜਾਬੀ ਭਾਸ਼ਾ ਨੂੰ ਮਾਂ ਬੋਲੀ ਪੰਜਾਬੀ ਦਾ ਦਰਜਾ ਮਿਲ ਗਿਆ